ਭੰਗੜਾ ਪਾਉਣ ਨਾਲ ਤੁਹਾਡਾ ਸਾਰਾ ਸਰੀਰ ਹਿੱਲਦਾ ਹੈ ਔਰ ਸਾਰੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਐਰੋਬਿਕਸ ਵਿੱਚ ਵੀ ਭੰਗੜਾ ਲੱਗਦਾ ਹੈ ਅਤੇ ਉਹ ਭੰਗੜਾ ਜਿਹੜਾ ਸਰੀਰ ਦੇ ਕਈ ਬਿਮਾਰੀਆਂ ਦੂਰ ਕਰਦਾ ਹੈ ਔਰ ਕਈ ਤੁਹਾਡੇ ਦਿਮਾਗ ਦੀਆਂ ਪਰੇਸ਼ਾਨੀਆਂ ਦੂਰ ਕਰਦਾ ਹੈ ਜਦੋਂ ਤੁਹਾਨੂੰ ਭੰਗੜਾ ਆ ਜਾਂਦਾ ਹੈ ਫਿਰ ਤੁਹਾਡੇ ਹਰ ਵੇਲੇ ਪੈਰ ਥਿਰਕਦੇ ਰਹਿੰਦੇ ਹਨ ਅਤੇ ਜਿਹੜੇ ਗਾਣੇ 'ਤੇ ਤੁਸੀਂ ਕਰਨਾ ਚਾਹੋ ਉਹ ਭੰਗੜਾ ਕਰ ਸਕਦੇ ਹੋ ਅਤੇ ਭੰਗੜਾ ਕਰਨ ਦਾ ਮਜ਼ਾ ਹੀ ਕੁਝ ਅਲੱਗ ਹੈ ਭੰਗੜੇ ਦੇ ਗਾਣੇ ਅਤੇ ਪੰਜਾਬੀ ਗਾਣੇ 'ਤੇ ਭੰਗੜਾ ਕਰਕੇ ਬਹੁਤ ਮਜ਼ਾ ਆਉਂਦਾ ਹੈ ਔਰ ਢੋਲ ਨਾਲ ਭੰਗੜਾ ਕਰਕੇ ਵੀ ਬੜਾ ਮਜ਼ਾ ਆਉਂਦਾ ਹੈ ਢੋਲ ਵੀ ਕਈ ਤਰ੍ਹਾਂ ਨਾਲ ਵੱਜਦਾ ਹੈ ਅਤੇ ਭੰਗੜਾ ਵੀ ਕਈ ਤਰ੍ਹਾਂ ਨਾਲ ਹੋ ਜਾਂਦਾ ਹੈ ਭੰਗੜੇ ਨਾਲ ਤੁਹਾਡਾ ਸਰੀਰ ਇੰਨਾਂ ਵਧੀਆ ਹੁੰਦਾ ਹੈ ਕਿ ਕਈ ਬਿਮਾਰੀਆਂ ਨੂੰ ਉਹ ਦੂਰ ਕਰਦਾ ਹੈ ਭੰਗੜਾ ਜਦੋਂ ਕਰਨ ਲੱਗ ਜਾਓ ਤੁਸੀਂ ਰੋਜ਼ ਰੋਜ਼ ਭੰਗੜਾ ਕਰਨ 'ਤੇ ਮਜਬੂਰ ਹੋ ਜਾਂਦੇ ਹੋ ਤੁਹਾਡਾ ਦਿਲ ਹਰ ਵੇਲੇ ਕਰਦਾ ਹੈ ਕਿ ਮੈਂ ਭੰਗੜਾ ਹੀ ਪਾਵਾਂ ਔਰ ਭੰਗੜਾ ਕਰਨ ਨਾਲ ਸਰੀਰ ਮਜ਼ਬੂਤ ਵੀ ਹੁੰਦਾ ਹੈ ਅਤੇ ਸਰੀਰ ਵਿੱਚ ਚੁਸਤੀ ਵੀ ਆਉਂਦੀ ਹੈ